ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੀ ਗੁੱਗਲ ਪੇ ਸਹੂਲਤ ਜਿਹੜੀ ਸਾਨੂੰ ਮਿਲੀ ਆ ਕੀ ਉਹ ਸੁਵਿਧਾਜਨਕ ਹੈਗੀ ਆ ਕਿ ਅਸੁਵਿਧਾਜਨਕ ਸਭ ਤੋਂ ਪਹਿਲਾਂ ਜਿਸ ਹਿਸਾਬ ਨਾਲ ਦੁਨੀਆ ਐਡਵਾਂਸ ਹੋ ਰਹੀ ਹੈ ਅਤੇ ਇੱਥੇ ਆਪਾਂ ਗੁੱਗਲ ਪੇ ਦੀ ਜਿਹੜੀ ਆ ਉਹਦੀ ਸਹੂਲਤ ਦੀ ਗੱਲ ਕਰਦੇ ਹਾਂ ਅਤੇ ਉਹਨੇ ਦੁਨੀਆ ਦੇ ਜਿਹੜੀ ਆ ਅਡਵਾਂਸ ਹੋਣਾ ਅਤੇ ਰੁਝੇਵੇਂ ਵਧਣਾ ਅਤੇ ਸਮੇਂ ਦੀ ਕਮੀ ਹੋਣਾ ਉਹ ਸਭ ਦੇ ਵਿੱਚ ਜਿਹੜਾ ਵਾ ਸੁਵਿਧਾਜਨਕ ਜਿਹੜੀ ਹੈ ਭੂਮਿਕਾ ਨਿਭਾਈ ਹੈ ਕਿਉਂਕਿ ਜਿਹੜਾ ਵਾ ਪਹਿਲਾਂ ਜਿਹੜਾ ਸੀ ਭੁਗਤਾਨ ਜਦੋਂ ਬੈਂਕਾਂ ਰਾਹੀਂ ਕਰਨਾ ਇੱਧਰ ਉੱਧਰ ਅਤੇ ਲਾਈਨਾਂ 'ਚ ਲੱਗਣਾ ਪੈਂਦਾ ਸੀ ਤਾਂ ਓਹਦੇ ਨਾਲ ਸਮੇਂ ਦੀ ਬਹੁਤ ਜਿਹੜੀ ਸੀ ਉਹ ਬਰਬਾਦੀ ਹੁੰਦੀ ਸੀ ਅੱਜ ਕੱਲ੍ਹ ਜਿਹੜਾ ਵਾ ਉਹ ਇੱਕ ਦੂਜੇ ਦੇ ਇਕੱਲੇ ਮੋਬਾਈਲ ਫੋਨ 'ਤੇ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਟਰਾਂਸਫਰ ਹੋ ਜਾਂਦੀਆਂ ਦੂਜਾ ਆਪਾਂ ਵੇਖਦੇ ਹਾਂ ਕਿ ਜਦੋਂ ਆਪਾਂ ਕਿਤੇ ਸ਼ੋਪਿੰਗ ਮੋਲ 'ਚ ਜਾਂਦੇ ਹਾਂ ਤਾਂ ਉੱਥੇ ਕੈਸ਼ ਪੇਮੈਂਟ ਨਹੀਂ ਹੁੰਦੀ ਉੱਥੇ ਗੂਗਲ ਪੇ ਚਲਦਾ ਹੈ ਤਾਂ ਓਹਦੇ ਨਾਲ ਕੀ ਹੁੰਦਾ ਕਿ ਜਦੋਂ ਅਸੀਂ ਗੂਗਲ ਦੇ ਥਰੂ ਕੋਈ ਪੇਮੈਂਟ ਕਰਦੇ ਹਾਂ ਅਤੇ ਉਹ ਸਾਡਾ ਪੱਕਾ ਸਾਡੇ ਕੋਲ ਜਿਹੜਾ ਵਾ ਉਹਦਾ ਰਿਕੋਡ ਜਿਹੜਾ ਵਾ ਉਹ ਰਹਿ ਜਾਂਦਾ ਕਿਉਂਕਿ ਉਹ ਜੋ ਵੀ ਅਸੀਂ ਭੁਗਤਾਨ ਕਰਦੇ ਹਾਂ ਕਿਸੇ ਸ਼ੋਪ 'ਤੇ ਸ਼ੋਪਕੀਪਰ ਨੂੰ ਅਤੇ ਉਸ ਪ੍ਰੋਪਰ ਜਿਹੜਾ ਵਾ ਉਹ ਸਾਡੇ ਫੋਨ ਦੇ ਵਿੱਚ ਉਹਦਾ ਰਿਕੋਡ ਹੁੰਦਾ ਸਾਨੂੰ ਇੱਕ ਰਸੀਦ ਵੀ ਮਿਲਦੀ ਹੈ ਜਿਹਦੇ ਤੋਂ ਸਾਨੂੰ ਜਿਹੜਾ ਵਾ ਉਹ ਕਲੀਅਰ ਹੋ ਜਾਂਦਾ ਕਿ ਅਸੀਂ ਇੰਨਾ ਜਿਹੜਾ ਵਾ ਉਹ ਭੁਗਤਾਨ ਕੀਤਾ ਇਸ ਲਈ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਇਸਨੇ ਦੁਨੀਆ ਨੂੰ ਕਾਫੀ ਸੁਵਿਧਾਜਨਕ ਬਣਾਇਆ ਹਾਂ ਕਈ ਥਾਵਾਂ 'ਤੇ ਅਸੁਵਿਧਾਜਨਕ ਵੀ ਸਾਬਿਤ ਹੁੰਦੀ ਹੈ ਕਿਉਂਕਿ ਕਈ ਵਾਰ ਜਦੋਂ ਆਪਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈੱਸ ਨਹੀਂ ਹੁੰਦੀ ਅਤੇ ਅਸੀਂ ਕਿਸੇ ਦੂਜੇ ਕੋਲੋਂ ਇਹ ਭੁਗਤਾਨ ਕਰਾਉਂਦੇ ਹਾਂ ਆਪਣਾ ਫੋਨ ਫੜਾਉਂਦੇ ਹਾਂ ਜਾਂ ਆਪਣਾ ਪਾਸਵਰਡ ਕੋਈ ਦੱਸਦੇ ਹਾਂ ਤਾਂ ਫੇਰ ਸਾਨੂੰ ਉਸ ਚੀਜ਼ ਦਾ ਜਿਹੜਾ ਵਾ ਉਹ ਨੁਕਸਾਨ ਵੀ ਹੋ ਜਾਂਦਾ ਕਿਉਂਕਿ ਕੋਈ ਸਾਡਾ ਜਿਹੜਾ ਵਾ ਏਸਸ ਮਦਦ ਕਰਨ ਦੇ ਚੱਕਰ ਵਿੱਚ ਕੋਈ ਸਾਡਾ ਫਾਇਦਾ ਵੀ ਜਿਹੜਾ ਵਾ ਉਹ ਚੁੱਕ ਸਕਦਾ ਵਾ ਠੀਕ ਹੈ ਜੀ ਇਸ ਲਈ ਜਿਹੜੀ ਆ ਇਹ ਸਹੂਲਤ ਆ ਜੇ ਇਹਦੇ ਬਹੁਤ ਸਾਰੇ ਫਾਇਦੇ ਆ ਤਾਂ ਕੁਝ ਨੁਕਸਾਨ ਵੀ ਜਿਹੜੇ ਹੈਗੇ ਆ ਪਰ ਜੇ ਅਸੀਂ ਸਿੱਟੇ 'ਤੇ ਪੁੱਜਣਾ ਤਾਂ ਇਹਨੇ ਅੱਜ ਦੀ ਭੱਜ ਦੌੜ ਦੀ ਦੁਨੀਆ ਵਿੱਚ ਜਿਹੜਾ ਵਾ ਉਹਦੇ ਵਿੱਚ ਇਹਦਾ ਕਾਫੀ ਮਹੱਤਵ ਅਤੇ ਮਹੱਤਵ ਹੈ ਅਤੇ ਅੱਜ ਦੇ ਸਮੇਂ ਦੀ ਇਹ ਜਿਹੜੀ ਹੈ ਇਹ ਲੋੜ ਹੈ ਧੰਨਵਾਦ